ਹਾਂ ਬੈਲਗੱਡੀ ਦੀ ਦੌੜ ਵੇਖੀ ਹੈ ਬੈਲਗੱਡੀ ਦੀ ਦੌੜ ਇੱਕ ਸਾਹਸਿਕ ਖੇਡ ਹੈ ਜੋ ਭਾਰਤ ਵਿੱਚ ਸਮਾਜਿਕ ਕਾਰਕਾਂ ਲਈ ਧੰਨ ਜੁਟਾਉਣ ਲਈ ਮਦਦ ਕਰਦੀ ਹੈ ਇਸ ਦੌੜ ਵਿੱਚ ਜਾਤੀਆਂ ਦੁਆਰਾ ਜਮਾਂ ਕੀਤੇ ਗਏ ਧਨ ਦਾ ਇਸਤੇਮਾਲ ਪਿੰਡ ਦੀ ਭਲਾਈ ਅਤੇ ਮੰਦਰਾਂ ਦੇ ਲਈ ਕੀਤੀ ਜਾਂਦੀ ਹੈ ਬੈਲਗੱਡੀ ਦੌੜ ਨੂੰ ਮੇਲਿਆਂ ਦੇ ਸਹਿਸਹਾਉਂਣ ਤੋਂ ਸਿਵਾ ਇੱਕ ਲਕਾਜ ਦੇ ਰੂਪ ਵਿੱਚ ਵੀ ਆਯੋਜਿਤ ਕੀਤਾ ਜਾਂਦਾ ਹੈ ਇਸ ਵਿੱਚ ਬੈਲ ਨੂੰ ਅੰਡਾ ਦੁੱਧ ਤੇਲ ਜਾਂ ਡਰਾਈ ਫਰੂਟ ਦਿੱਤੇ ਜਾਂਦੇ ਹਨ ਇਹ ਕੁਝ ਸੌ ਮੀਟਰ ਦੀ ਦੂਰੀ ਦੀ ਦੌੜ ਹੁੰਦੀ ਹੈ ਇਸ ਤੋਂ ਇਲਾਵਾ ਬੈਲ ਦੀ ਕੀਮਤ ਇੱਕ ਲੱਖ ਜਾਂ ਡੇਢ ਲੱਖ ਰੁਪਏ ਹੁੰਦੀ ਹੈ ਇਸ ਤੋਂ ਇਲਾਵਾ ਛੱਤੀਸਗੜ੍ਹ ਵਿੱਚ ਮੁਰਗੇ ਦੀ ਲੜਾਈਆਂ ਕਰਵਾਈਆਂ ਜਾਂਦੀ ਹਨ ਇਹ ਲੜਾਈਆਂ ਆਦਿਵਾਸੀ ਗ੍ਰਾਮੀਣ ਦੇ ਮਨੋਰੰਜਨ ਦਾ ਸਾਧਨ ਹੈ ਇਸ ਲੜਾਈ ਵਿੱਚ ਦੋ ਮੁਰਗਿਆਂ ਨੂੰ ਆਪਸ ਵਿੱਚ ਲੜਾਇਆ ਜਾਂਦਾ ਹੈ ਅਤੇ ਜਿੱਤਣ ਵਾਲੇ ਮੁਰਗੇ ਦਾ ਮਾਲਕ ਹਾਰਨ ਵਾਲੇ ਮੁਰਗੇ ਨੂੰ ਨਾਲ ਲੈ ਜਾਂਦਾ ਹੈ ਮੁਰਗਾ ਲੜਾਈ ਗ੍ਰਾਮੀਣ ਦੁਆਰਾ ਲੱਖਾਂ ਰੁਪਏ ਦਾ ਦਾਓ ਖੇਡਿਆ ਜਾਂਦਾ ਹੈ ਇਸ ਤੋਂ ਇਲਾਵਾ ਘੋੜੇ ਦੀਆਂ ਦੌੜ੍ਹਾਂ ਹੁੰਦੀਆਂ ਹਨ ਜਿਸ ਵਿੱਚ ਘੋੜੇ ਵੱਡੇ ਮੈਦਾਨ ਵਿੱਚ ਦੌੜਦੇ ਹਨ ਅਤੇ ਜੋ ਜਿਸ ਦਾ ਘੋੜਾ ਜਿੱਤ ਜਾਵੇ ਉਸ ਨੂੰ ਲੱਖਾਂ ਰੁਪਏ ਮਿਲਦੇ ਹਨ ਧੰਨਵਾਦ